ਹੈਲੋ ਹਾਂਜੀ ਹਾਂਜੀ ਸਰ ਬੋਲੀਏ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਓ ਕਦੋਂ ਸਰ ਕਾਫ਼ੀ ਟਾਈਮ ਪਹਿਲਾਂ ਹਾਂਜੀ ਹਾਂਜੀ ਯਾਦ ਆ ਗਿਆ ਜੀ ਹਾਂਜੀ ਹਾਂਜੀ ਗਏ ਸੀ ਉਦੋਂ ਹਾਂਜੀ ਹਾਂਜੀ ਚਲਦੇ ਰਹਿਣਾ ਕਦੋਂ ਜਾਣਾ ਕਦੋਂ ਜਾਣਾ ਸਰ ਦੱਸੋ ਠੀਕ ਐ ਜੀ ਠੀਕ ਐ ਜੀ ਆਪਣੇ ਕੋਲ ਨਵੀਂ ਲਿੱਤੀ ਐ ਆਪਾਂ ਸਵਿਫਟ ਡਜੈਰ ਸਰ ਨਹੀਂ ਸਰ ਸਹੀ ਸੀ ਸਰ ਚਲੋ ਕੋਈ ਨੀ ਤੁਸੀਂ ਕਹਿੰਦੇ ਆਪਾਂ ਧਿਆਨ ਨਾਲ ਚਲਾ ਲੈਣੀ ਆ ਹੂੰ ਉਹ ਸਰ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨੀ ਸਰ ਕੋਈ ਗੱਲ ਨੀ ਸਰ ਹੁਣ ਸ਼ਿਕੈਤ ਦਾ ਮੌਕਾ ਨੀ ਆਏਗਾ ਸਰ ਪੂਰੀ ਧਿਆਨ ਨਾਲ ਚਲਾਵਾਂਗੇ ਸਰ ਹਾਂਜੀ ਹਾਂਜੀ ਕੋਈ ਦਿੱਕਤ ਆਲੀ ਗੱਲ ਨੀ ਹਾਂਜੀ ਹਾਂਜੀ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਬਸ ਸਰ ਓਹੀ ਜਿਹੜਾ ਤਾਡੇ ਕੋਲੋਂ ਰੇਟ ਲੈਨੇ ਆ ਸਰ ਉਹ ਪੈਸੇ ਤੇ ਦਸ ਰੁਪਈਏ ਚੱਲਦਾ ਸਰ ਆਪਾਂ ਸੱਤ ਰੁਪਏ ਧਾਨੂੰ ਲਾ ਦਿਆਂਗੇ ਲੈੱਸ ਕਰਕੇ ਬਸ ਧਾਡੇ ਓਹੀ ਰੇਟ ਲਵਾਂਗੇ ਸਰ ਤੁਹਾਡੇ ਨਾਲ ਕੋਈ ਹੈ ਈ ਨੀ ਐ ਸਰ ਤੁਸੀਂ ਦੇਖੋ ਸਰ ਜਿਵੇਂ ਤੁਹਾਨੂੰ ਕੰਫਰਟੇਬਲ ਲੱਗਦਾ ਵੀ ਓਮੇ ਕਰ ਦਿਆ ਵੀ ਕੈਸ਼ ਕਰ ਦਿਆ ਜੇ ਗੂਗਲ ਪੇਅ ਕਰਦਿਆ ਜੇ ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਪੰਜ ਸੌ ਕਿਲੋਮੀਟਰ ਹੋ ਗਏ ਨਾ ਅੱਪ ਡਾਊਨ ਸਰ ਹੂੰ ਬਣ ਗਿਆ ਸੱਤੂ ਪੰਜਾ ਪੈਂਤੀ ਸੌ ਰੁਪਈਆ ਹੋ ਗਿਆ ਸਰ ਤੇ ਸਰ ਇਨ ਦੇ ਚ ਇੱਕ ਗੱਲ ਨੋਟ ਕਰਾਂ ਟੋਲ ਟੈਕਸ ਜਿੰਨੇ ਵੀ ਪੈਣਗੇ ਤੁਸੀਂ ਪੇਅ ਕਰੋਗੇ ਸਰ ਹਾਂਜੀ ਹਾਂਜੀ ਨਾਲ ਪਲੱਸ ਟੋਲ ਟੈਕਸ ਜੋ ਵੀ ਪੈਣਗੇ ਉਹ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਫੇਰ ਐਂ ਕਰੋ ਇੱਕ ਅਰੀ ਹਾਂ ਹਾਂ ਦੋ ਹਜਾਰ ਰੁਪਈਆ ਗੂਗਲ ਪੇਅ ਕਰ ਦਿਆ ਜੇ ਹੁਣੇ ਤੇ ਡੇਟ ਦੱਸੋ ਸਰ ਕਿਹੜੀ ਡੇਟ ਤੇ ਜਾਣਾ ਹਾਂਜੀ ਕਿਹੜੀ ਡੇਟ ਤੇ ਜਾਣਾ ਸਰ ਠੀਕ ਐ ਕਿੰਨੀਆਂ ਸਵਾਰੀਆਂ ਸਰ ਅੱਛਾ ਬਸ ਫੇਰ ਠੀਕ ਐ ਫੇਰ ਕੰਫਰਟੇਬਲ ਐ ਕੋਈ ਚੱਕਰ ਨੀ ਨਵੀਂ ਲਿੱਤੀ ਗੱਡੀ ਸਰ ਸ਼ਿਕੈਤ ਦਾ ਮੌਕਾ ਨੀ ਦਵਾਂਗੇ ਤੁਹਾਨੂੰ ਕੋਈ ਚੱਕਰ ਆਲੀ ਗੱਲ ਨੀ ਸਰ ਠੀਕ ਐ ਸਰ ਕੋਈ ਨੀ ਸਰ ਉਹ ਬਾਕੀ ਦੇਖਲਾਂਗੇ ਕਾਰ 'ਚ ਦੇਖਲਾਂਗੇ ਸਰ ਕੋਈ ਚੱਕਰ ਨੀ ਆ ਤੇ ਬਸ ਤੁਸੀਂ ਮੈਨੂੰ ਡੇਟ ਤੇ ਟਾਈਮ ਨੋਟ ਕਰਵਾ ਦਿਆ ਕਦੋਂ ਚੱਲਣਾ ਠੀਕ ਐ ਓਕੇ ਠੀਕ ਠੀਕ ਐ